ਪਹਿਲਾਂ ਅਸੀਂ ਹਿਸਾਬ ਕਿਤਾਬ ਕਿਸੇ ਨੂੰ ਸੰਦੇਸ਼ ਭੇਜਣ ਲਈ ਚਿੱਠੀਆਂ ਦੀ ਵਰਤੋਂ ਕਰਦੇ ਸੀ ਪਰ ਟੈਕਨੋਲਜੀ ਆਉਣ ਕਾਰਨ ਸਾਡੇ ਲਈ ਬਹੁਤ ਚੀਜ਼ਾਂ ਬਹੁਤ ਹੀ ਜ਼ਿਆਦਾ ਆਸਾਨ ਹੋ ਗਈਆਂ ਹਨ ਜਿਵੇਂ ਪਹਿਲਾਂ ਕਿਸੇ ਨੂੰ ਚਿੱਠੀਆਂ ਭੇਜਦੇ ਸੀ ਪਰ ਟੈਕਨੋਲੋਜੀ ਦੀ ਵਰਤੋਂ ਨਾਲ ਅਸੀਂ ਹੁਣ ਫੋਨ ਵਟਸਐਪ ਰਾਹੀਂ ਆਪਣੇ ਸੰਦੇਸ਼ ਭੇਜ ਸਕਦੇ ਹਾਂ ਜੋ ਕਿ ਬਹੁਤ ਜਲਦੀ ਅਤੇ ਆਸਾਨੀ ਨਾਲ ਅੱਗੇ ਪਹੁੰਚ ਜਾਂਦੇ ਹਨ ਇਸ ਤੋਂ ਇਲਾਵਾ ਕਿਸੇ ਨੂੰ ਮਿਲਣ ਜਾਣ ਲਈ ਦੂਰ ਦੁਰਾਡੇ ਬੈਠਿਆਂ ਬਹੁਤ ਮੁਸ਼ਕਲ ਹੁੰਦੀ ਸੀ ਪਰ ਟੈਕਨੋਲੋਜੀ ਦੀ ਮਦਦ ਨਾਲ ਅਸੀਂ ਵੀਡੀਓ ਕਾਲ ਉੱਤੇ ਸਭ ਨੂੰ ਦੇਖ ਸਕਦੇ ਹਾਂ ਹਿਸਾਬ ਕਿਤਾਬ ਲਈ ਪਹਿਲਾਂ ਬਹੀ ਕਾਪੀਆਂ ਵਰਤੀਆਂ ਜਾਂਦੀਆਂ ਸੀ ਪਰ ਹੁਣ ਦੇ ਸਮੇਂ ਵਿੱਚ ਟੈਕਨੋਲੋਜੀ ਨੇ ਬਹੁਤ ਆਸਾਨ ਕਰ ਦਿੱਤਾ ਹੈ ਅਸੀਂ ਹਿਸਾਬ ਕਿਤਾਬ ਫੋਨ ਦੇ ਉੱਤੇ ਜਾਂ ਕਿਸੇ ਵੀ ਹੋਰ ਸਾਧਨ ਉੱਪਰ ਬਹੁਤ ਆਸਾਨੀ ਨਾਲ ਟੈਕਨੋਲੋਜੀ ਦੀ ਮਦਦ ਨਾਲ ਕਰ ਸਕਦੇ ਹਾਂ ਟੈਕਨੋਲੋਜੀ ਬਹੁਤ ਸਾਰੇ ਕੰਮਾਂ ਵਿੱਚ ਭਰੋਸੇਮੰਦ ਸਾਬਿਤ ਹੋਈ ਹੈ